ਹਾਂ ਮੈਂ ਇੱਕ ਵਾਰ ਨਾ ਭੰਗੜਾ ਕਲਾਸਸ ਗਈ ਸੀਗੀ ਅਤੇ ਅਸੀਂ ਗਏ ਸਰ ਨੇ ਸਾਨੂੰ ਕਿਹਾ ਕਿ ਅੱਜ ਨਾ ਤਾਂ ਤੁਸੀਂ ਰੋਟੀ ਖਾਣੀ ਕਹਿੰਦੇ ਨਾ ਤੁਸੀਂ ਪਾਣੀ ਖਾਣੀ ਅਤੇ ਕਹਿੰਦੇ ਜਿਹੜਾ ਤੁਸੀਂ ਥੋੜ੍ਹਾ ਬਹੁਤਾ ਜੰਕ ਫੂਡ ਖਾਂਦੇ ਹੋ ਨਾ ਕਹਿੰਦੇ ਉਹ ਵੀ ਤੁਹਾਡਾ ਬੰਦ ਕਰਾ ਦੇਣਾ ਅਸੀਂ ਸਰ ਨੂੰ ਕਿਹਾ ਕਿ ਬਈ ਸਰ ਕਿਉਂ ਤੁਸੀਂ ਐਂ ਕਾਹਤੋਂ ਸਾਨੂੰ ਕਹਿੰਦੇ ਹੋ ਉਹ ਸਰ ਕਹਿੰਦੇ ਕਿ ਤੁਸੀਂ ਜੰਕ ਫੂਡ ਖਾ ਖਾ ਕੇ ਫਿਰ ਤੁਸੀਂ ਕਹਿੰਦੇ ਹੋ ਸਾਡੇ ਭੰਗੜਾ ਕਰਦੇ ਅਤੇ ਵੱਖੀਆਂ ਚੜ੍ਹਦੀਆਂ ਫਿਰ ਅਸੀਂ ਕਿਹਾ ਚਲੋ ਠੀਕ ਆ ਸਰ ਫਿਰ ਅਸੀਂ ਸ਼ੁਰੂ ਜਦੋਂ ਕੀਤੀ ਆਪਦੀ ਪ੍ਰੈਕਟਿਸ ਹੈ ਨਾ ਪਹਿਲਾਂ ਤਾਂ ਵਧੀਆ ਅਸੀਂ ਕਰੀ ਗਏ ਕਰੀ ਗਏ ਕਰੀ ਗਏ ਫਿਰ ਉਹ ਕਹਿੰਦਾ ਕਿ ਅੱਜ ਨਾ ਕਿਸੇ ਗੈਸਟ ਨੇ ਆਉਣਾ ਕਹਿੰਦਾ ਉਹਨੇ ਤੁਹਾਡਾ ਨਾ ਭੰਗੜਾ ਓਬਜਰਵ ਕਰਨਾ ਕਿ ਤੁਸੀਂ ਕਿਵੇਂ ਵਧੀਆ ਕਰੀ ਜਾਂਦੇ ਹੋ ਕਿ ਕਿਵੇਂ ਕਰੀ ਜਾਂਦੇ ਮੈਂ ਕਿਹਾ ਸਰ ਠੀਕ ਆ ਅਸੀਂ ਠੀਕ ਆ ਵਧੀਆ ਕਰੀ ਗਏ ਕਰੀ ਗਏ ਕਰੀ ਗਏ ਉਹ ਗੈਸਟ ਜਾਵੇ ਹੀ ਨਾ ਉਹ ਬੈਠਾ ਹੀ ਰਿਹਾ ਉਹ ਤਾਂ ਸਵੇਰ ਤੋਂ ਲੈ ਕੇ ਜਦੋਂ ਤੱਕ ਸਾਢੇ ਨੌ ਵਜੇ ਦਾ ਮਤਲਬ ਕਿ ਸਵੇਰ ਦੇ ਜਿਵੇਂ ਛੇ ਵਜੇ ਅਸੀਂ ਉੱਠਦੇ ਹਾਂ ਹੈ ਨਾ ਜਿਵੇਂ ਅਸੀਂ ਨੌ ਮਤਲਬ ਸਾਢੇ ਅੱਠ ਕੁ ਵਜੇ ਅਸੀਂ ਘਰੋਂ ਨਿਕਲਦੇ ਹਾਂ ਸਾਢੇ ਅੱਠ ਵਜੇ ਜਾਂਦੇ ਹਾਂ ਅਤੇ ਵਧੀਆ ਅਸੀਂ ਚਾਰ ਜਾਂ ਪੰਜ ਵਜੇ ਉੱਥੋਂ ਅਸੀਂ ਕੋਚਿੰਗ ਆਪਦੀ ਕਲਾਸ ਤੋਂ ਆ ਜਾਂਦੇ ਭੰਗੜੇ 'ਤੇ ਹੈ ਨਾ ਅਤੇ ਉਹ ਤਾਂ ਸਾਰੀ ਦਿਹਾੜੀ ਬੈਠੇ ਹੀ ਰਿਹਾ ਉਹ ਤਾਂ ਕਹਿੰਦਾ ਮੈਂ ਤਾਂ ਵੇਖ ਕੇ ਜਾਊਂਗਾ ਉਹ ਤਾਂ ਸਾਨੂੰ ਰਿਕਾਰਡਿੰਗ ਕਰਨ ਲੱਗ ਗਿਆ ਅਤੇ ਅਸੀਂ ਇੱਧਰ ਅਸੀਂ ਤਾਂ ਉਈਂ ਇੱਕ ਥੱਕੇ ਹੋਏ ਸੀਗੇ ਅਤੇ ਅਸੀਂ ਕਰ ਕਰ ਕੇ ਭੰਗੜਾ ਤਾਂ ਉਈਂ ਥੱਕ ਗਏ ਹੈਂ ਫਿਰ ਉਹ ਅਸੀਂ ਸਰ ਨੂੰ ਵੀ ਬਾਵਾ ਇਸ਼ਾਰਿਆਂ ਨਾਲ ਕਹਿ ਕੇ ਸਰ ਬਸ ਕਰੋ ਬਸ ਕਰੋ ਸਾਡੇ ਤੋਂ ਹੁਣ ਨਹੀਂ ਹੁੰਦਾ ਇੰਨਾ ਭੰਗੜਾ ਹੈ ਨਾ ਉਹ ਸਰ ਸਾਡੀ ਮੰਨੇ ਹੀ ਨਾ ਉਹ ਸਰ ਸਾਨੂੰ ਕਹੀ ਜਾਵੇ ਕਿ ਹੁਣ ਤੁਸੀਂ ਕੇਰਾਂ ਫਸ ਤਾਂ ਚੁੱਕੇ ਹੋ ਕਹਿੰਦੇ ਹੁਣ ਕਰੀ ਚਲੋ ਸਾਨੂੰ ਤਾਂ ਬਰੇਕ ਵੀ ਨਹੀਂ ਮਿਲੀ ਪਾਣੀ ਪੀਣ ਨੂੰ ਮਸਾਂ ਸਾਨੂੰ ਇੱਕ ਦੁੱਖ ਸਾਨੂੰ ਤਾਂ ਇਹੀ ਕਹਿੰਦੇ ਸੀ ਵੀ ਬਸ ਸੰਘ ਹੀ ਗਿੱਲਾ ਕਰਨਾ ਇਕੱਲਾ ਮੂੰਹ ਗਿੱਲਾ ਕਰਨਾ ਕਹਿੰਦੇ ਕਿ ਬਸ ਅਸੀਂ ਉਧਰ ਇੰਨਾ ਭੰਗੜਾ ਕੀਤਾ ਮੈਨੂੰ ਲੱਗਦਾ ਇੰਨਾ ਕਦੇ ਅਸੀਂ ਲਾਈਫ 'ਚ ਨਹੀਂ ਕੀਤਾ ਹੋਣਾ ਜਾਂ ਅਸੀਂ ਇੱਥੇ ਵਿਆਹਾਂ 'ਤੇ ਨਹੀਂ ਕੀਤਾ ਹੋਣਾ ਜਿੰਨਾ ਅਸੀਂ ਭੰਗੜਾ ਉੱਥੇ ਕੀਤਾ ਜਿੱਦਣ ਸਰ ਆਇਆ ਸੀਗਾ ਅਤੇ ਬਈ ਉਦਣ ਜਦੋਂ ਉਹ ਸਰ ਗਿਆ ਫਿਰ ਅਸੀਂ ਰੋਟੀ ਖਾਦੀ ਫਿਰ ਅਸੀਂ ਘਰੇ ਗਏ ਅਤੇ ਬਸ ਘਰ ਜਾ ਕੇ ਅਸੀਂ ਸਿੱਧਾ ਲੰਮੇ ਪੈ ਗਏ ਬੈਡ 'ਤੇ ਘਰਦੇ ਕਹਿੰਦੇ ਕੀ ਹੋਇਆ ਕਹਿੰਦੇ ਕਿ ਬਈ ਸਾਡਾ ਤਾਂ ਭੰਗੜਾ ਕਰ ਕਰ ਕੇ ਬੁਰਾ ਹਾਲ ਹੋ ਗਿਆ ਉਹ ਤਾਂ ਕਹਿੰਦੇ ਨਾਲੇ ਤਾਂ ਤੁਸੀਂ ਕਹਿੰਦੇ ਸਾਨੂੰ ਖੁਸ਼ੀ ਮਿਲਦੀ ਸਾਡੀ ਹੋਬੀ ਆ ਭੰਗੜਾ ਕਰਨਾ ਪਰ ਹੁਣ ਅਸੀਂ ਕੀ ਕਰ ਸਕਦੇ ਹਾਂ ਉਹਦੇ ਵਿੱਚ ਹੈ ਨਾ ਵੀ ਉਹ 'ਚ ਹੁਣ ਸਾਡੀ ਤਾਂ ਕੋਈ ਗਲਤੀ ਨਹੀਂ ਅਸੀਂ ਤਾਂ ਐਸ ਏ ਸ਼ੌਕ ਨੂੰ ਕੀਤਾ ਸੀਗਾ ਫਿਰ ਸਾਨੂੰ ਕੇਰਾਂ ਤਾਂ ਐਂ ਲੱਗਿਆ ਕਿ ਭੰਗੜੇ ਕਲਾਸਾਂ ਆ ਕੇ ਜੋਆਇਨ ਕਰਕੇ ਤਾਂ ਅਸੀਂ ਆਪਦੇ ਹੀ ਪੈਰ 'ਤੇ ਕੁਹਾੜੀ ਮਾਰ ਲਈ ਪਰ ਫਿਰ ਕਿਹਾ ਕਿ ਚੱਲ ਜੇ ਜੋਇਨ ਕੀਤਾ ਐਵੇਂ ਘਰਦਿਆਂ ਨੇ ਵੀ ਗਾਲਾਂ ਕੱਢਣੀਆਂ ਸੀ ਜੇ ਪਹਿਲਾਂ ਤਾਂ ਤੁਸੀਂ ਰੌਲਾ ਪਾਈ ਜਾਂਦੇ ਸੀਗੇ ਕਿ ਹਾਂ ਭੰਗੜਾ ਕਲਾਸਸ ਜੁਆਇਨ ਕਰਨੀ ਆ ਭੰਗੜਾ ਕਲਾਸਸ ਜੁਆਇਨ ਕਰਨੀ ਆ ਹੁਣ ਜਦੋਂ ਭੰਗੜਾ ਕਲਾਸ ਤੁਹਾਡੀ ਜੁਆਇਨ ਹੋ ਗਈ ਕਹਿੰਦੇ ਹੁਣ ਤੁਸੀਂ ਆਪ ਹੀ ਪਿੱਟਦੇ ਫਿਰਦੇ ਹੋ ਫਿਰ ਹੁਣ ਘਰ ਦੇ ਜਦੋਂ ਸਾਨੂੰ ਕੰਮ ਕਹਿੰਦੇ ਅਸੀਂ ਕਹਿੰਦੇ ਸਾਡੀਆਂ ਲੱਤਾਂ 'ਚ ਖੱਲੀਆਂ ਪਈਆਂ ਹੋਈਆਂ ਉਹ ਫਿਰ ਸਾਨੂੰ ਕਹਿੰਦੇ ਆ ਕਿ ਹਾਂ ਕਿ ਚੰਗੀਆਂ ਤੁਸੀਂ ਭੰਗੜੇ ਦੀਆਂ ਕਲਾਸਾਂ ਜੁਆਇਨ ਕੀਤੀਆਂ ਕਹਿੰਦੇ ਨਾ ਤਾਂ ਤੁਸੀਂ ਘਰ ਦੇ ਕੰਮ ਕਰਦੇ ਹੋ ਨਾ ਕੁਝ ਬਸ ਉਦਣ ਤਾਂ ਅਸੀਂ ਇਹਨਾਂ ਥੱਕ ਚੁੱਕੇ ਨਾ ਉਹ ਤਾਂ ਸਾਡਾ ਯਾਦਗਾਰੀ ਸੀਗਾ ਕਿ ਓਦਣ ਜਿੰਨਾ ਅਸੀਂ ਭੰਗੜਾ ਕਦੇ ਨਹੀਂ ਪਾਇਆ ਫਿਰ ਸਾਨੂੰ ਵਿਆਹਾਂ ਵਿੱਚ ਵੀ ਭੰਗੜੇ ਤੋਂ ਨਫਰਤ ਹੀ ਹੋਣ ਲੱਗ ਗਈ ਫਿਰ ਸਾਨੂੰ ਉਹੀ ਸੀਨ ਯਾਦ ਆ ਜਾਂਦਾ ਸੀਗਾ ਕਿ ਹਾਂ ਕਿ ਅਸੀਂ ਜਿੰਨਾ ਸਾਰੀ ਦਿਹਾੜੀ ਭੰਗੜਾ ਕੀਤਾ ਅਤੇ ਬਸ ਓਹੀ ਹੁਣ ਸੀਨ ਵਾਰ ਵਾਰ ਯਾਦ ਆਈ ਜਾਂਦਾ